ਅੱਜ ਕੱਲ੍ਹ ਦੀ ਉਹ ਘਟਨਾ ਜੋ ਕਿ ਮੈਨੂੰ ਬਹੁਤ ਹੀ ਦਿਲਚਸਪ ਲੱਗਦੀ ਹੈ ਉਹ ਹੈ ਰਾਮ ਮੰਦਰ ਰਾਮ ਮੰਦਰ ਹਿੰਦੂ ਧਰਮ ਦਾ ਇੱਕ ਬਹੁਤ ਹੀ ਵੱਡਾ ਮੰਦਰ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਰਾਮ ਮੰਦਰ ਅਯੋਧਿਆ ਵਿੱਚ ਬਣ ਰਿਹਾ ਹੈ ਇਸ ਤੋਂ ਬਣਨ ਵਿੱਚ ਦੋ ਸਾਲ ਲੱਗ ਗਏ ਲੇਕਿਨ ਇਸ ਨੂੰ ਬਣਾਉਣ ਲਈ ਹਿੰਦੂ ਧਰਮ ਦੁਆਰਾ ਕੀਤਾ ਗਿਆ ਸੰਘਰਸ਼ ਇਹ ਭੁਲਾਇਆ ਨਹੀਂ ਜਾ ਸਕਦਾ ਰਾਮ ਮੰਦਰ ਕਿਉਂਕਿ ਹਿੰਦੂ ਧਰਮ ਦਾ ਇੱਕ ਬਹੁਤ ਹੀ ਵੱਡਾ ਆਸਥਾ ਦਾ ਕੇਂਦਰ ਹੈ ਜੋ ਕਿ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਰ ਬਣਨ ਜਾ ਰਿਹਾ ਹੈ ਹਿੰਦੂ ਧਰਮ ਨੇ ਰਾਮ ਮੰਦਰ ਬਣਾਉਣ ਲਈ ਬਹੁਤ ਹੀ ਜ਼ਿਆਦਾ ਸੰਘਰਸ਼ ਕੀਤਾ ਰਾਮ ਮੰਦਰ ਦੀ ਜਗ੍ਹਾ ਪਹਿਲਾਂ ਬਾਬਰੀ ਮਸਜਿਦ ਹੋਇਆ ਕਰਦਾ ਸੀ ਜਿਸ ਤੋਂ ਬਾਅਦ ਉੱਥੇ ਰਾਮ ਮੰਦਰ ਦੇ ਕੁਛ ਪ੍ਰਮਾਣ ਮਿਲੇ ਜਿਸ ਵਿੱਚ ਸਰਕਾਰ ਨੇ ਹੋਰ ਕਾਰਵਾਈ ਚਲਾਈ ਜਿਸ ਤੋਂ ਬਾਅਦ ਇਹ ਪਾਇਆ ਗਿਆ ਕਿ ਉਸ ਮਸਜਿਦ 'ਚ ਇਹ ਜਗ੍ਹਾ ਇੱਕ ਰਾਮ ਮੰਦਰ ਸੀ ਅਤੇ ਬਹੁਤ ਹੀ ਲੰਬੇ ਸੰਘਰਸ਼ ਤੋਂ ਬਾਅਦ ਅੱਜ ਉੱਥੇ ਮੰਦਰ ਬਣਨ ਜਾ ਰਿਹਾ ਹੈ ਅੱਜ ਜਦੋਂ ਉੱਥੇ ਮੰਦਰ ਦਾ ਉਦਘਾਟਨ ਹੋਏਗਾ ਤਾਂ ਪੂਰਾ ਹਿੰਦੂ ਧਰਮ ਬਹੁਤ ਹੀ ਖੁਸ਼ੀ ਦੀ ਲਹਿਰ ਨਾਲ ਝੂਮ ਉੱਠੇਗਾ